ਅੱਜ ਕੱਲ੍ਹ ਦੇਖਿਆ ਜਾਵੇ ਤਾਂ ਟੀ ਵੀ ਤਾਂ ਕੋਈ ਇੱਕ ਅਜਿਹਾ ਚੈਨਲ ਵੀ ਮੁਫਤ ਵਿੱਦਿਅਕ ਸਮੱਗਰੀ ਉਪਲਬਧ ਨਹੀਂ ਕਰਦਾ ਅੱਜ ਕੱਲ੍ਹ ਤਾਂ ਹਰੇਕ ਚੀਜ਼ ਪੈਸੇ ਦੇ ਕੇ ਖਰੀਦੀ ਜਾਂਦੀ ਹੈ ਉਹ ਔਨਲਾਈਨ ਪੜ੍ਹਾਈ ਹੀ ਦੀ ਟਿਊਸ਼ਨ ਕਿਉਂ ਨਾ ਹੋਵੇ ਇਸਦੇ ਅਨੁਸਾਰ ਇੱਦਾਂ ਹੋਣਾ ਚਾਹੀਦਾ ਹੈ ਕਿ ਟੀ ਵੀ ਦੇ ਰਾਹੀਂ ਫ਼ੋਨ 'ਤੇ ਵੈੱਬਸਾਈਡਾਂ ਕੋਈ ਵੀ ਫਰੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਬੱਚਿਆਂ ਦਾ ਪੜ੍ਹਨ ਅਤੇ ਹੋਰ ਚੀਜ਼ਾਂ ਵੱਲ ਧਿਆਨ ਜਾ ਸਕੇ ਅਤੇ ਹੋਰ ਵੀ ਬਹੁਤ ਸਾਰੀਆਂ ਉਪਲਬਧੀਆਂ ਫਰੀ ਕਰਵਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਪੜ੍ਹਾਈ ਦੇ ਅਨੁਸਾਰ ਕੋਈ ਸ਼ੋਅ ਵਗੈਰਾ ਦਿਖਾਉਣੇ ਚਾਹੀਦੇ ਨੇ